ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਕੌਰ ਤੁਸੀਂ ਗੋਪਾਲ ਸਵੀਟਸ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੀ ਰੈਗੂਲਰ ਕਸਟਮਰ ਹਾਂ ਮੈਂ ਤੁਹਾਡੇ ਰੈਸਟੋਰੈਂਟ ਵਿੱਚ ਆਉਂਦੀ ਜਾਂਦੀ ਰਹਿੰਦੀ ਹਾਂ ਇਸ ਕਰਕੇ ਠੰਡ ਦੇ ਮੌਸਮ ਵਿੱਚ ਮੇਰੇ ਭੈਣਾਂ ਨੇ ਮੈਨੂੰ ਕਿਹਾ ਵੀ ਅੱਜ ਗੋਪਾਲ ਸਵੀਟਸ ਤੋਂ ਔਨਲਾਈਨ ਔਡਰ ਕਰ ਸ ਕਰ ਲੈਂਦੇ ਹਾਂ ਅਤੇ ਜਿਸ ਵਿੱਚ ਫਿਰ ਮੈਨੇ ਤੁਹਾਨੂੰ ਪੁੱਛਣਾ ਵੀ ਤੁਸੀਂ ਮੇਰੇ ਐਡਰੈੱਸ 'ਤੇ ਹੋਮ ਡਿਲੀਵਰੀ ਕਰ ਸਕਦੇ ਹੋ ਜੇ ਤੁਸੀਂ ਮੇਰੇ ਐਡਰੈੱਸ 'ਤੇ ਹੋਮ ਡਿਲੀਵਰੀ ਕਰ ਸਕਦੇ ਹੋ ਤਾਂ ਤੁਸੀਂ ਮੇਰਾ ਐਡਰ ਔਡਰ ਲਿਖ ਸਕਦੇ ਹੋ ਐਡਰੈੱਸ ਮੈਂ ਤੁਹਾਨੂੰ ਵਟਸਐਪ 'ਤੇ ਸੈਂਡ ਕਰ ਦਾਂਗੀ ਮੇਰੇ ਔਡਰ ਲਿਖ ਲਓ ਜਿਸ ਵਿੱਚ ਸਮੋਸੇ ਗੁਲਾਬ ਜਾਮੁਣਾ ਅਤੇ ਜਲੇਬੀਆਂ ਆਦਿ ਸ਼ਾਮਿਲ ਹਨ ਅਤੇ ਮੈਂ ਤੁਹਾਨੂੰ ਤੁਹਾਨੂੰ ਪੇਅਮੈਂਟ ਔਨਲਾਈਨ ਜਾਂ ਔਫਲਾਈਨ ਦੋਨੋਂ ਤਰ੍ਹਾਂ ਦੀ ਕਰ ਸਕਦੀ ਹਾਂ ਵੈਸੇ ਤਾਂ ਮੈਂ ਕੈਸ਼ ਓਨ ਡਿਲੀਵਰੀ ਪੇਅਮੈਂਟ ਕਰਾਂਗੀ ਠੀਕ ਹੈ ਜੀ ਮੈਂ ਤੁਹਾਡੇ ਐ ਔਡਰ ਦਾ ਵੇਟ ਕਰਾਂਗੀ